ਪੰਜਾਬ ਵਿੱਚ ਨਿਊਜ਼ ਮੀਡੀਆ ਕਾਰੋਬਾਰ ਕਾਫੀ ਵੱਡਾ ਹੈ ਲੰਬਾ ਚੋੜਾ ਹੈ ਇਹ ਇਹਦੀ ਜਿਹੜੀ ਅ ਮੀਡੀਆ ਦੇ ਵਿੱਚ ਜਿਹੜੀ ਐਡ ਆਉਂਦੀ ਹੈ ਵਿਗਿਆਪਨਾਂ ਦੀਆਂ ਉਹ ਜਿੰਨੀ ਜ਼ਿਆਦਾ ਆ ਰਹੀ ਹੈ ਉਹਦੇ ਨੂੰ ਪ ਕੁਛ ਜੀ ਐਸ ਟੀ ਪੰਜਾਬ ਸਰਕਾਰ ਜਾਂ ਇੰਡੀ ਜਾਂ ਪਾ ਭਾਰਤ ਦੇ ਪ੍ਰਸਾਸ਼ਨ ਨੂੰ ਮਜ਼ਬੂਤ ਕਰਦੀ ਹੈ ਉਹ ਅਰਥਸ਼ਾਸ਼ਤਰ ਵਿੱਚ ਕਾਫੀ ਲੰਬੀ ਚੋੜੀ ਰਕਮ ਜੇ ਅਖ਼ਬਾਰ ਨੂੰ ਆਉਂਦੀ ਹੈ ਉਹੀ ਪੰਜਾਬ ਸਰਕਾਰ ਨੂੰ ਉਹੀ ਅਰਥਸ਼ਾਸ਼ਤਰ ਦੇ ਨਾਲ ਜਿਹੜੀ ਹੈ ਉਸ ਮੈ ਸਰਕਾਰ ਮਜ਼ਬੂਤ ਹੁੰਦੀ ਹੈ ਮੀਡੀਆ ਦੇ ਕਾਰੋਬਾਰ ਦੇ ਵਿੱਚ ਕੁਛ ਅਖ਼ਬਾਰਾਂ ਨੂੰ ਜਿਹੜੀ ਹੈ ਅਖ਼ਬਾਰ ਛੋਟੀਆਂ ਅਖ਼ਬਾਰਾਂ ਨੂੰ ਅਖ਼ਬਾਰ ਜਿਹੜੀ ਹੈ ਐਡ ਘੱਟ ਮਿਲਦੀ ਹੈ ਅਤੇ ਬੜੀ ਜ਼ਿਆਦਾ ਮਿਲਦੀ ਹੈ ਇਸ ਕਰਕੇ ਅਖ਼ਬਾਰਾਂ ਜਿਹੜੀਆਂ ਲੋਅ ਲੈਵਲ ਦੀਆਂ ਉਹ ਟਿਕੀਆਂ ਰਹਿੰਦੀਆਂ ਬੜੇ ਲੈਵਲ ਦੀਆਂ ਹਾਈ ਲੈਵਲ ਦੀਆਂ ਉੱਪਰ ਚਲ ਜਾਂਦੀਆਂ ਹਨ ਅਤੇ ਇਹਨਾਂ ਨੂੰ ਇਹੀ ਜਿਹੜੀਆਂ ਪ੍ਰਭਾਵਿਤ ਕਰਦੀਆਂ ਕੁਛ ਅਖ਼ਬਾਰਾਂ ਜਿਹੜੀਆਂ ਉਹਨਾਂ ਨੂੰ ਜਦੋਂ ਪੰਜਾਬ ਸਰਕਾਰ ਐਡ ਨਹੀਂ ਦੇ ਰਹੀ ਉਹਨਾਂ ਨੇ ਐਡ ਬੰਦ ਕਰਤੀ ਉਹ ਅਖ਼ਬਾਰਾਂ ਕਿੰਨੀਆਂ ਚੱਲਦੀਆਂ ਸੀ ਅੱਜ ਕੱਲ੍ਹ ਅਪ ਡਾਊਨ ਹੋ ਗਈਆਂ ਕਾਫੀ ਅਤੇ ਉਹਨਾਂ ਦੇ ਜਿਹੜੇ ਵ ਵਰਕਰ ਵੀ ਕੰਮ ਕਰਦੇ ਸੀਗੇ ਉਹ ਵੀ ਹੁਣ ਨੌਕਰੀ ਤੋਂ ਨੌਕਰੀ ਤੋਂ ਬਾਹਰ ਜਾ ਰਹੇ ਨੇ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ ਵੀ ਦੂਸਰੇ ਪਾਸੇ ਜਿਹੜੀਆਂ ਅਖ਼ਬਾਰਾਂ ਨੂੰ ਪੰਜਾਬ ਸਰਕਾਰ ਐਡ ਦਿੰਦੀ ਸਰਕਾਰ ਦੀ ਐਡ ਦੇਣ ਨਾਲ ਅਖ਼ਬਾਰਾਂ ਕਾਫੀ ਪ੍ਰਫੁੱਲਤ ਹੋ ਰਹੀਆਂ ਹਨ ਉੱਪਰ ਜਾ ਰਹੀਆਂ ਹਨ ਮੀਡੀਆ ਕਾਰੋਬਾਰ ਜਿਹੜਾ ਹੈ ਐਡ 'ਤੇ ਵਿਗਿਆਪਨ 'ਤੇ ਟਿਕਿਆ ਹੈ ਅਤੇ ਇਸੇ ਟੀਕੇ ਇਸ ਮੀ ਮੀਡੀਆ ਪਰਵਾਨ ਇਸ ਦੇ ਕਾਰੋਬਾਰ ਨਾਲ ਹੀ ਚੱਲਣਾ ਹੈ ਅਤੇ ਖ਼ਬਰਾਂ ਦਾ ਉਹਨਾਂ ਨੂੰ ਜ਼ਿਆਦਾ ਨਹੀਂ ਹੈ ਖ਼ਬਰ ਸਿਰਫ ਅਖ਼ਬਾਰ ਭਰਨ ਨੂੰ ਹੀ ਵਰਤਦੇ ਹਨ ਅਤੇ ਬਾਕੀ ਜਿਹੜੇ ਅਰਥਸ਼ਾਸਤਰ ਨੂੰ ਮਜ਼ਬੂਤ ਐਡ ਹੀ ਕਰਦੀਆਂ ਹਨ